ਭੰਗੜਾ ਇੱਕ ਜੀਵੰਤ ਅਤੇ ਊਰਜਾਵਾਨ ਨਾਚ ਹੈ ਜੋ ਪੰਜਾਬੀ ਸੱਭਿਆਚਾਰ ਵਿੱਚ ਮਹੱਤਵਪੂਰਨ ਸੱਭਿਆਚਾਰਕ ਮਹੱਤਵ ਰੱਖਦਾ ਹੈ ਇਸ ਦੀਆਂ ਜੜ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਦੀਆਂ ਪਰੰਪਰਾਵਾਂ ਵਿੱਚ ਡੂੰਘੀਆਂ ਹਨ ਅਤੇ ਇਹ ਖੁਸ਼ੀ ਜਸ਼ਨ ਅਤੇ ਫਿਰਕੂ ਭਾਵਨਾਵਾਂ ਦੇ ਪ੍ਰਤੀਕ ਵਜੋਂ ਕੰਮ ਕਰਦੀਆਂ ਹਨ ਇੱਥੇ ਭੰਗੜੇ ਦੇ ਮਹੱਤਵ ਅਤੇ ਤਿਉਹਾਰਾਂ ਵਿੱਚ ਇਸਦੀ ਭੂਮਿਕਾ ਬਾਰੇ ਇੱਕ ਡੂੰਘੀ ਵਿਚਾਰ ਹੈ ਇਤਿਹਾਸਿਕ ਜੜ੍ਹਾਂ ਭੰਗੜਾ ਪੰਜਾਬੀ ਕਿਸਾਨਾਂ ਦੁਆਰਾ ਵਾਢੀ ਦੇ ਮੌਸਮ ਖਾਸ ਕਰਕੇ ਵਿਸਾਖੀ ਦੇ ਤਿਉਹਾਰ ਦੌਰਾਨ ਮਨਾਉਣ ਲਈ ਪੇਸ਼ਕਸ਼ ਕੀਤੇ ਗਏ ਇੱਕ ਰਿਵਾਇਤੀ ਲੋਕ ਨਾਚ ਵਜੋਂ ਉਤਪੰਨ ਹੋਇਆ ਹੈ ਭਾਈਚਾਰਾ ਅਤੇ ਪਛਾਣ ਭੰਗੜਾ ਪੰਜਾਬੀ ਪਹਿਛਾਣ ਅਤੇ ਮਾਣ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਬਣ ਗਿਆ ਹੈ ਇਹ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ ਭਾਈਚਾਰੇ ਅਤੇ ਸੱਭਿਆਚਾਰਕ ਨਿਰੰਤਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਆਨੰਦ ਦਾ ਪ੍ਰਗਟਾਵਾ ਨਾਚ ਨੂੰ ਇਸ ਦੇ ਉਤਸ਼ਾਹੀ ਟੈਂਪੋ ਊਰਜਾਵਾਨ ਹਰਕਤਾਂ ਅਤੇ ਜੀਵੰਤ ਬੀਟਾਂ ਦੁਆਰਾ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ ਜਿਸ ਨਾਲ ਇਹ ਜਸ਼ਨ ਦੇ ਸਮੇਂ ਪ੍ਰਗਟਾਵੇ ਦਾ ਇੱਕ ਆਦਰਸ਼ ਰੂਪ ਬਣ ਜਾਂਦਾ ਹੈ ਤਿਉਹਾਰਾਂ ਵਿੱਚ ਭੰਗੜੇ ਦੀ ਭੂਮਿਕਾ ਵਿਸਾਖੀ ਭੰਗੜੇ ਨਾਲ ਸਬੰਧਿਤ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਵਿਸਾਖੀ ਹੈ ਜੋ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਅਤੇ ਸਿੱਖਾਂ ਲਈ ਧਾਰਮਿਕ ਮਹੱਤਤਾ ਰੱਖਦੀ ਹੈ ਵਿਆਹ ਵਿਆਹ ਪੰਜਾਬੀ ਪੰਜਾਬੀ ਵਿਆਹਾਂ ਵਿੱਚ ਭੰਗੜਾ ਤਿਉਹਾਰ ਦਾ ਮੁੱਖ ਹਿੱਸਾ ਹੈ ਇਹ ਜਸ਼ਨਾਂ ਵਿੱਚ ਇੱਕ ਜਵੰਤ ਅਤੇ ਅਨੰਦ ਮਈ ਮਾਹੌਲ ਨੂੰ ਜੋੜਦਾ ਹੈ ਇਸ ਵਿੱਚ ਲਾੜੀ ਅਤੇ ਲਾੜੇ ਦੇ ਪਰਿਵਾਰ ਦੋਵੇਂ ਡਾਂਸ ਰੂਟੀਨ ਵਿੱਚ ਹਿੱਸਾ ਲੈਂਦੇ ਹਨ ਇਹ ਦੋ ਪਰਿਵਾਰਾਂ ਦੇ ਮਿਲਾਪ ਅਤੇ ਵਿਆਹ ਦੇ ਖੁਸ਼ੀ ਮੌਕੇ ਨੂੰ ਮਨਾਉਣ ਦਾ ਇੱਕ ਤਰੀਕਾ ਹੈ ਸੱਭਿਆਚਾਰਕ ਤਿਉਹਾਰ ਰਿਵਾਇਤੀ ਸਮਾਗਮਾਂ ਤੋਂ ਇਲਾਵਾ ਭੰਗੜੇ ਨੂੰ ਵਿਸ਼ਵ ਭਾਰਤ ਦੇ ਵੱਖ ਵੱਖ ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਵਿੱਚ ਵੀ ਪ੍ਰਦਰਸ਼ਿਤ ਕਰਦਾ ਹੈ ਸੰਖੇਪ ਵਿੱਚ ਭੰਗੜਾ ਕੇਵਲ ਇੱਕ ਡਾਂਸ ਫਾਰਮ ਤੋਂ ਬਹੁਤ ਜ਼ਿਆਦਾ ਹੈ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ ਜੋ ਤਿਉਹਾਰਾਂ ਦੇ ਜਸ਼ਨਾਂ ਨੂੰ ਆਪਣੇ ਜੀਵੰਤ ਊਰਜਾ ਅਤੇ ਸੱਭਿਆਚਾਰ ਮਹੱਤਤਾ ਨਾਲ ਭਰਪੂਰ ਬਣਾਉਂਦਾ ਹੈ